ਮੈਂ ਆਪਣੇ ਕੋਲੇਜ ਦੇ ਦੌਰਾਨ ਯੂਥ ਫੈਸਟ ਯੂਥ ਫੈਸਟੀਵਲ ਵਿੱਚ ਭਾਗ ਲਿਆ ਸੀ ਜਿਸ ਵਿੱਚ ਮੈਂ ਗਿੱਧੇ ਵਿੱਚ ਹਿੱਸਾ ਲਿਆ ਸੀ ਸਾਡੀ ਟੀਮ ਪਹਿਲੇ ਦਰਜੇ 'ਤੇ ਆਈ ਸੀ ਅਤੇ ਅਸੀਂ ਗੋਲਡ ਮੈਡਲ ਪ੍ਰਾਪਤ ਕੀਤਾ ਸੀ ਸਾਡੇ ਕੋਲੇਜ ਵਿੱਚ ਗਿੱਧੇ ਭੰਗੜੇ ਯੂ ਫੰਕਸ਼ਨ ਹੁੰਦੇ ਰਹਿੰਦੇ ਹਨ